ਫੋਟੋਗ੍ਰਾਫਰ ਅਤੇ ਫੋਟੋ ਦੇ ਵਿਸ਼ੇ ਵਿਚਕਾਰ ਸੰਬੰਧ ਅੰਤਿਮ ਚਿੱਤਰ ਨੂੰ ਬਹੁਤ ਹੀ ਬਖੂਬੀ ਢੰਗ ਨਾਲ ਪ੍ਰਭਾਵਿਤ ਕਰਦਾ ਹੈ ਮੈਂ ਇਸ ਗੱਲ ਦਾ ਉਦਾਹਰਣ ਦੇ ਸਕਦੀ ਹਾਂ ਪਿੱਛੇ ਜਿਹੇ ਇੱਕ ਮੈਂ ਤਸਵੀਰ ਖਿੱਚਣ ਦੀ ਕੋਸ਼ਿਸ਼ ਕੀਤੀ ਸੀ ਆਪਣੇ ਫੋਨ ਤੋਂ ਅਤੇ ਮੈਂ ਮਹਿਸੂਸ ਕੀਤਾ ਸੀ ਕਿ ਉਸ ਦਿਨ ਮੈਨੂੰ ਬਹੁਤ ਹੀ ਖੁਸ਼ੀ ਸੀ ਮਨ ਉਲਾਸ ਸੀ ਬਹੁਤ ਹੀ ਸੋਹਣਾ ਦਿਨ ਸੀ ਤਾਂ ਜਦੋਂ ਫੋਟੋ ਖਿੱਚੀ ਤਾਂ ਫੋਟੋ ਵੀ ਓਨੀ ਹੀ ਸੋਹਣੀ ਆਈ ਅਤੇ ਮਹਿਸੂਸ ਕੀਤਾ ਕਿ ਵਾਕੇ ਹੀ ਜਦੋਂ ਤੁਸੀਂ ਖੁਸ਼ ਹੁੰਨੇ ਹੋ ਤਾਂ ਤੁਹਾਡਾ ਅਤੇ ਤੁਹਾਡੀ ਜਿਹੜੀ ਫੋਟੋ ਦਾ ਜਿਹੜਾ ਅੰਤਿਮ ਚਿੱਤਰ ਹੈ ਉਹ ਵੀ ਸੋਹਣਾ ਹੀ ਨਿਕਲ ਕੇ ਆਉਂਦਾ ਹੈ ਅਤੇ ਉਲਾਸ ਭਰਿਆ ਹੁੰਦਾ ਹੈ